ਮੈਂ ਆਟੋਮੈਟਿਕ ਅਨੁਵਾਦ ਦੀ ਗੂਗਲ ਮੈਪ ਦੀ ਵਰਤੋਂ ਬਹੁਤ ਜ਼ਿਆਦਾ ਮਤਲਬ ਨਹੀਂ ਕੀਤੀ ਪਰ ਹੈਗਾ ਕਦੀ ਕਦਾ ਜਦੋਂ ਅਸੀਂ ਸਾਨੂੰ ਕਿਤੇ ਦੂਰ ਦਰਾਜ ਜਾਣਾ ਪੈਂਦਾ ਅਸੀਂ ਨਹੀਂ ਕਿਸੇ ਨੂੰ ਜਾਣਦੇ ਅਤੇ ਅਸੀਂ ਫਿਰ ਗੂਗਲ ਐਪ ਦੀ ਵਰਤੋਂ ਕਰਦੇ ਹਨ ਔਰ ਸਹੀ ਵੀ ਹੁੰਦਾ ਕਾਫੀ ਹੱਦ ਤੱਕ ਸਹੀ ਹੁੰਦਾ ਬਸ ਐਹ ਹੈਗਾ ਕਿ ਉਹਦੇ ਵਿੱਚ ਥੋੜ੍ਹਾ ਜਾ ਸਾਨੂੰ ਜਿਹੜੀ ਚੀਜ਼ ਦਸ ਮਿੰਟ ਦਾ ਰਸਤਾ ਹੁੰਦਾ ਉਹ ਸਾਨੂੰ ਵੀਹ ਪੱਚੀ ਮਿੰਟ ਲੱਗ ਜਾਂਦੇ ਆ ਥੋੜ੍ਹਾ ਘੁੰਮਣਾ ਪੈਂਦਾ ਲੇਕਿਨ ਰਸਤਾ ਸਾਨੂੰ ਸਹੀ ਦੱਸਦਾ ਗੂਗਲ ਮੈਪ ਵਰਤੋਂ ਇਹਦੀ ਠੀਕ ਹੈ ਹਾਂਜੀ ਥੋੜ੍ਹਾ ਸਹੀ ਹੈ ਮਤਲਬ ਅਸੀਂ ਇਹਨੂੰ ਅੱਸੀ ਪ੍ਰਸੈਂਟ ਤੱਕ ਸਹੀ ਕਹਿ ਸਕਦੇ ਹਾਂ ਗੂਗਲ ਮੈਪ ਨੂੰ ਉਹ ਸਾਡੀ ਮਦਦ ਕਰਦਾ ਜਿੱਦਾਂ ਪਹਿਲੇ ਟਾਈਮ ਦੇ ਲੋਕੀ ਪੁੱਛਦੇ ਸੀ ਕਿ ਕਿੱਦਾਂ ਕਿੱਦਾਂ ਜਾਣਾ ਕਿੱਥੇ ਜਾਣਾ ਜਾਣਾ ਪੈਣਾ ਪੁੱਛ ਪੁੱਛ ਕੇ ਅੱਜ ਕੱਲ੍ਹ ਗੂਗਲ ਮੈਪ ਖੋਲੀਦਾ ਅਤੇ ਸਿੱਧਾ ਉਹ ਰਸਤੇ 'ਤੇ ਪਹੁੰਚ ਜਾਈਦਾ ਮਤਲਬ ਸਹੀ ਆ ਕਾਫੀ ਹੱਦ ਤੱਕ